ਸਤਿ ਸ਼੍ਰੀ ਅਕਾਲ ਜੀ ਜੇਕਰ ਮੈਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਪਿਕਨਿਕ 'ਤੇ ਜਾਣਾ ਹੋਵੇ ਤਾਂ ਮੈਂ ਛੋਟੀ ਬਾਰਾਂਦਰੀ ਜੋ ਕਿ ਪਟਿਆਲਾ ਵਿਖੇ ਸਥਿਤ ਹੈ ਜਾਣਾ ਪਸੰਦ ਕਰਦੀ ਹਾਂ ਇੱਥੇ ਵੱਡੇ ਵੱਡੇ ਦਰੱਖਤ ਹਰਿਆਲੀ ਅਤੇ ਰੰਗ ਬਿਰੰਗੇ ਫੁੱਲ ਬਹੁਤ ਹੀ ਸੋਹਣੇ ਲੱਗਦੇ ਹਨ ਦਰੱਖਤਾਂ ਤੋਂ ਸਾਨੂੰ ਤਾਜ਼ੀ ਹਵਾ ਮਿਲਦੀ ਹੈ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਇੱਥੇ ਵਾਤਾਵਰਨ ਬਹੁਤ ਹੀ ਸ਼ਾਂਤ ਹੁੰਦਾ ਹੈ ਅਸੀਂ ਇਕੱਠੇ ਮਿਲ ਕੇ ਅੰਤਾਕਸ਼ਰੀ ਖੇਡਦੇ ਹਾਂ ਬੱਚੇ ਕਈ ਵਾਰ ਇੱਥੇ ਡਾਂਸ ਵੀ ਕਰ ਲੈਂਦੇ ਹਾ ਹਨ ਅਸੀਂ ਇੱਥੇ ਲੰਬੀ ਸੈਰ ਦਾ ਆਨੰਦ ਵੀ ਮਾਣਦੇ ਹਾਂ ਇੱਥੇ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਇੱਥੇ ਬੱਚਿਆਂ ਅਤੇ ਵੱਡਿਆਂ ਦੇ ਵਾਸਤੇ ਝੂਟਿਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਅਤੇ ਨਾਲ ਖੇਡਣ ਵਾਸਤੇ ਕੁਝ ਗੇਮਜ਼ ਵੀ ਹਨ ਅਸੀਂ ਝੂਟਿਆਂ ਦਾ ਆਨੰਦ ਵੀ ਲੈਂਦੇ ਹਾਂ ਜਿਸ ਦੇ ਨਾਲ ਸਭ ਦਾ ਮਨੋਰੰਜਨ ਹੁੰਦਾ ਹੈ ਅਸੀਂ ਆਪਣੇ ਨਾਲ ਖਾਣ ਪੀਣ ਵਾਸਤੇ ਕੁਝ ਸਮਾਨ ਵੀ ਲੈ ਕੇ ਜਾਂਦੇ ਹਾਂ ਸਾਰੇ ਮਿਲ ਕੇ ਇੱਥੇ ਬਹੁਤ ਹੀ ਵਧੀਆ ਸਮਾਂ ਗੁਜ਼ਾਰਦੇ ਹਨ ਬੱਚੇ ਤਾਂ ਇੱਥੇ ਆਉਣ ਵਾਸਤੇ ਹਮੇਸ਼ਾ ਹੀ ਉਤਸੁਕ ਰਹਿੰਦੇ ਹਨ ਦੋਸਤਾਂ ਦੇ ਨਾਲ ਮਿਲ ਕੇ ਕਈ ਵਾਰ ਇੱਥੇ ਗਿਆਨ ਦੀਆਂ ਗੱਲਾਂ ਵੀ ਹੋ ਜਾਂਦੀਆਂ ਹਨ ਅਤੇ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਹੈ ਛੁੱਟੀ ਵਾਲੇ ਦਿਨ ਅਸੀਂ ਇੱਥੇ ਆਉਣਾ ਬਹੁਤ ਹੀ ਪਸੰਦ ਕਰਦੇ ਹਾਂ ਅਤੇ ਉਹ ਦਿਨ ਸਾਡਾ ਬਹੁਤ ਹੀ ਵਧੀਆ ਨਿਕਲਦਾ ਹੈ ਜਿਸ ਦਿਨ ਅਸੀਂ ਇੱਥੇ ਪਿਕਨਿਕ ਮਨਾਉਣ ਲਈ ਆਉਂਦੇ ਹਾਂ ਧੰਨਵਾਦ ਜੀ